ਮੈਂ ਜੀ ਇੰਡੀਅਨ ਆਇਡਲ ਸ਼ੋ ਬਹੁਤ ਹੀ ਜ਼ਿਆਦਾ ਵੇਖਦਾ ਜੀ ਅਤੇ ਇਹਦੇ ਵਿੱਚੋਂ ਪਵਨ ਜੀ ਸਾਡੇ ਮੇਨ ਨੇ ਜਿਹਦੇ ਨਾਲ ਬਹੁਤ ਹੀ ਚੰਗਾ ਗਾਈਡ ਕਰਦੇ ਨੇ ਅਤੇ ਇਸ ਲਈ ਪੁਰਾਣੇ ਗਾਣੇ ਬਹੁਤ ਹੀ ਵਧੀਆ ਲੱਗਦਾ ਜਿਹੜਾ ਵਾਰ ਵਾਰ ਦੇਖਣ ਨੂੰ ਦਿਲ ਕਰਦਾ ਇਸ ਲਈ ਗਾਣੇ ਜਿੰਨੇ ਵੀ ਸ਼ੋ ਆਉਂਦੇ ਨੇ ਇਹ 'ਚ ਹਿੰਦੀ ਗਾਣੇ ਬਹੁਤ ਹੀ ਵਧੀਆ ਔਰ ਚੰਗੇ ਲੱਗਦੇ ਨੇ ਇਸ ਲਈ ਨਵੇਂ ਗਾਣਿਆਂ ਦੇ ਕੋਈ ਸਮਝ ਨਹੀਂ ਆਉਂਦੀ ਪੁਰਾਣੇ ਗਾਣੇ ਦਾ ਕੋਈ ਮਤਲਬ ਵੀ ਹੈਗਾ ਲੇਕਿਨ ਨਵੇਂ ਗਾਣੇ ਦਾ ਨਾ ਕੋਈ ਮਤਲਬ ਹੁੰਦਾ ਨਾ ਕੋਈ ਸ਼ੋ ਹੁੰਦਾ